ਹਾਂਜੀ ਤੁਸੀਂ ਕਸਟਮਰ ਸਰਵਿਸ ਤੋਂ ਬੋਲ ਰਹੇ ਹੋ ਹੇਅਰ ਕੇਅਰ ਬ੍ਰੈਨ ਦੇ ਮੈਂ ਐਕਚੁਲੀ ਦੋ ਕੁ ਹਫਤੇ ਪਹਿਲਾਂ ਇੱਕ ਪ੍ਰੋਡਕਟ ਰਿਪੀਟ ਵਾਸਤੇ ਮੰਗਾਇਆ ਸੀ ਮਤਲਬ ਮੈਂ ਸੈਕਿੰਡ ਟਾਈਮ ਮੰਗਾਇਆ ਸੀ ਪ੍ਰੋਡਕਟ ਮੇਰਾ ਫਸਟ ਐਕਸਪੀਰੀਐਂਸ ਕਾਫੀ ਅੱਛਾ ਰਿਹਾ ਸੀ ਪਰ ਜਦੋਂ ਮੈਂ ਸੈਕਿੰਡ ਟਾਈਮ ਮੰਗਵਾਇਆ ਹੈ ਤਾਂ ਪਹਿਲੀ ਗੱਲ ਤਾਂ ਵੀ ਜਿਹੜੀ ਡਿਲੀਵਰੀ ਆਈ ਹੈ ਉਹਦੇ ਅੰਦਰ ਹੀ ਪ੍ਰੋਡਕਟ ਹਾਫ ਡੈਮੇਜਡ ਹੈ ਮੈਂ ਟੂ ਬੋਟਲਸ ਮੰਗਵਾਈਆਂ ਸੀ ਅਤੇ ਉਹਦੇ ਅੰਦਰੋਂ ਵਨ ਬੋਟਲ ਬਿਲਕੁਲ ਡੈਮੇਜਡ ਹੈ ਉਹਦੀ ਐਕਸਪਾਇਰੀ ਡੇਟ ਵੀ ਨਿਕਲ ਚੁੱਕੀ ਹੈ ਜਿਹੜਾ ਸੈਕਿੰਡ ਬੋਟਲ ਤੁਸੀਂ ਭੇਜੀ ਹੈ ਉਹਦੇ ਅੰਦਰ ਉਹ ਜਿਹੜਾ ਸਾਈਜ਼ ਕੁਆਂਟਿਟੀ ਮੈਂ ਜਿਹੜੀ ਔਰਡਰ ਕੀਤੀ ਸੀ ਉਸ ਤੋਂ ਡਿਫਰੈਂਟ ਕੁਆਂਟਿਟੀ ਆਈ ਹੈ ਮੈਂ ਬਿਗ ਸਾਈਜ਼ ਔਰਡਰ ਕੀਤਾ ਸੀ ਤੁਸੀਂ ਸੇਮ ਵਰਾਇਟੀ ਦਾ ਸਮੋਲ ਸਾਈਜ਼ ਭੇਜਿਆ ਹੈ ਤਾਂ ਤੁਸੀਂ ਉਹਨੂੰ ਚੇਂਜ ਕਰਕੇ ਪਲੀਜ਼ ਮੈਨੂੰ ਦੱਸਦੋ